ਹੈਲੋ ਹਾਂਜੀ ਮੇਰਾ ਨਾਮ ਨੀਰੂ ਹੈ ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਅੱਜ ਅਸੀਂ ਬਿਜਲੀ ਦੇ ਬਾਰੇ ਅਸੀਂ ਕੁਛ ਖਤਰਿਆਂ ਤੋਂ ਜਾਣੂ ਹਾਂ ਅਸੀਂ ਇਹ ਕਹਿ ਸਕਦੇ ਕਿ ਸਾਨੂੰ ਬਿਜਲੀ ਦੀ ਜਿਹੜੀ ਵਰਤੋਂ ਹੈ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ ਕਿ ਬਿਜਲੀ ਦੇ ਨਾਲ ਅਸੀਂ ਜਿਸ ਤਰ੍ਹਾਂ ਸਾਡੇ ਫਰਿੱਜ ਹੋ ਗਏ ਟੀ ਵੀ ਹੋ ਗਏ ਔਰ ਵਾਸ਼ਿੰਗ ਮਸ਼ੀਨ ਹੋ ਗਈ ਬਹੁਤ ਹੀ ਤਰੀਕੇ ਨਾਲ ਸਾਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਅਸੀਂ ਕੱਪੜੇ ਧੋਂਦੇ ਹਾਂ ਔਰ ਗਿੱਲੇ ਕੱਪੜੇ ਹੁੰਦੇ ਆ ਸਾਨੂੰ ਇਕਦਮ ਬਿਜਲੀ ਨੂੰ ਮਤਲਬ ਕਿ ਉਸਨੂੰ ਹੱਥ ਨਹੀਂ ਲਗਾਉਣਾ ਚਾਹੀਦਾ ਸਵਿੱਚ ਨੂੰ ਉਸਨੂੰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਬੰਦ ਕਰਕੇ ਕਰਨਾ ਚਾਹੀਦਾ ਹੈ ਜਿਸ ਕਰਕੇ ਸਾਨੂੰ ਅਰਥ ਕਈ ਵਕਤ ਉਹ ਆਪਸ 'ਚ ਜੁੜ ਜਾਂਦੇ ਔਰ ਸਾਨੂੰ ਕਰੰਟ ਲੱਗ ਸਕਦਾ ਹੈ ਇਸ ਲਈ ਜਿਸ ਤਰ੍ਹਾਂ ਫਰਿੱਜ ਹੋ ਗਿਆ ਫਰਿੱਜ ਦੀਵਾਰ ਤੋਂ ਕਾਫੀ ਦੂਰ ਹੋਣਾ ਚਾਹੀਦਾ ਹੈ ਜਿਸ ਕਰਕੇ ਇਕਦਮ ਬਿਜਲੀ ਦਾ ਗਰਮ ਹੋ ਜਾਂਦੀ ਹੈ ਔਰ ਫਰਿੱਜ ਮਤਲਬ ਕਿ ਫਟ ਸਕਦਾ ਹੈ ਇਸ ਕਰਕੇ ਸਾਨੂੰ ਬਿਜਲੀ ਤੋਂ ਬਹੁਤ ਹੀ ਮਤਲਬ ਕਿ ਖਤਰਿਆਂ ਤੋਂ ਬਚਣਾ ਚਾਹੀਦਾ ਹੈ ਔਰ ਸਾਵਧਾਨੀ ਨਾਲ ਸਾਨੂੰ ਇਸਤੇਮਾਲ ਕਰਨੀ ਚਾਹੀਦੀ ਹੈ ਜਿੱਦਾਂ ਹੀਟਰ ਹੋ ਗਏ ਹੋਰ ਵੀ ਕਈ ਇਸ ਤਰ੍ਹਾਂ ਦੀਆਂ ਬਿਜਲੀ ਦੀਆਂ ਚੀਜ਼ਾਂ ਹਨ ਜਿਹੜੀਆਂ ਮਤਲਬ ਕਿ ਆਪਣੇ ਕੀ ਬੋਲਦੇ ਹੈ ਅਸੀਂ ਰੋਡ ਲਗਾਉਂਦੇ ਹਾਂ ਰੋਡ ਲਗਾਉਣ ਨਾਲ ਇਹ ਹੁੰਦਾ ਬਿਜਲੀ ਦਾ ਅਰਥ ਪਾਣੀ ਦੇ ਵਿੱਚ ਹੁੰਦਾ ਆ ਸਾਨੂੰ ਉਸ ਪਾਣੀ ਦੇ ਵਿੱਚ ਹੱਥ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਉਹਦੇ ਵਿੱਚ ਕਰੰਟ ਹੁੰਦਾ

ਸਾਨੂੰ ਇਸ ਕਰਕੇ ਜੇ ਸਾਨੂੰ ਇਕਦਮ ਕਿਸੇ ਵਕਤ ਸਾਨੂੰ ਬਿਜਲੀ ਤਾਂ ਕਰੰਟ ਵੀ ਲੱਗੇ ਤਾਂ ਸਾਨੂੰ ਉਹਦੇ ਤੋਂ ਬਚਣ ਲਈ ਇੱਕ ਲੱਕੜੀ ਦਾ ਸਹਾਰਾ ਸਹਾਇਤਾ ਲੈਣੀ ਚਾਹੀਦੀ ਹੈ ਇਕਦਮ ਸਾਨੂੰ ਅਸੀਂ ਮਤਲਬ ਨੰਗੇ ਪੈਰ ਨਹੀਂ ਸਾਨੂੰ ਹੋਣਾ ਚਾਹੀਦਾ ਸਾਨੂੰ ਹਮੇਸ਼ਾ ਚੱਪਲ ਪਾ ਕੇ ਹੀ ਕੱਪੜੇ ਧੋਣੇ ਚਾਹੀਦੇ ਹੈ ਔਰ ਆਪਣੇ ਗਿੱਲੇ ਕੱਪੜੇ ਨਹੀਂ ਹੋਣੇ ਚਾਹੀਦੇ ਸਾਡੇ ਔਰ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਹੋਏ ਇਕਦਮ ਸਾਨੂੰ ਪਿੱਛੋਂ ਸਵਿੱਚ ਮਤਲਬ ਮੇਨ ਸਵਿੱਚ ਬੰਦ ਕਰ ਦੇਣਾ ਚਾਹੀਦਾ ਹੈ ਜਿਹਦੇ ਕਰਕੇ ਵੀ ਸਾਡਾ ਬਚਾਅ ਹੋ ਸਕੇ ਔਰ ਲੱਕੜ ਦੀ ਵਰਤੋਂ ਸਾਨੂੰ ਕਰਨੀ ਚਾਹੀਦੀ ਹੈ ਥੈਂਕ ਯੂ ਜੀ